ਹਾਂਜੀ ਮੈਨੂੰ ਗਾਉਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਛੋਟੇ ਹੁੰਦਿਆਂ ਤੋਂ ਹੀ ਗਾਉਣ 'ਚ ਕਾਫ਼ੀ ਰੁਚੀ ਰੱਖਦੀ ਸੀ ਮੈਂ ਭਾਵੇਂ ਆਪਣੀ ਗਾਇਕੀ ਨੂੰ ਐਜ ਏ ਪ੍ਰੋਫੈਸ਼ਨ ਕਦੇ ਵੀ ਨਹੀਂ ਲਿਆ ਪਰ ਮੇਰੇ ਪਰਿਵਾਰ ਵਾਲੇ ਅਤੇ ਮੇਰੀਆਂ ਸਹੇਲੀਆਂ ਅਨੁਸਾਰ ਮੈਂ ਵਧੀਆ ਗਾਉਂਦੀ ਸੀ ਅਤੇ ਸਾਰੇ ਮੇਰੀ ਆਵਾਜ਼ ਅਤੇ ਅੰਦਾਜ਼ ਨੂੰ ਕਾਫ਼ੀ ਪਸੰਦ ਕਰਦੇ ਸਨ ਮੇਰੇ ਇਸ ਸ਼ੋਂਕ ਨੂੰ ਅੱਗੇ ਲੈ ਕੇ ਜਾਣ ਵਿੱਚ ਮੇਰੀ ਸਹੇਲੀ ਰਾਜਵਿੰਦਰ ਦਾ ਬਹੁਤ ਯੋਗਦਾਨ ਰਿਹਾ ਹੈ ਕਿਉਂਕਿ ਉਹ ਮੇਰੀ ਗਾਇਕੀ ਨੂੰ ਹਮੇਸ਼ਾ ਹੀ ਸਰਾਹੁਦੀ ਸੀ ਅਤੇ ਤਾਰੀਫ਼ ਕਰਦੀ ਸੀ ਇਸ ਕਾਰਨ ਮੈਂ ਅੱਜ ਵੀ ਘਰ ਵਿੱਚ ਕੰਮ ਕਾਰ ਕਰਨ ਵੇਲੇ ਗਾਉਂਦੀ ਰਹਿੰਦੀ ਹਾਂ ਅਤੇ ਆਪਣੇ ਪਰਿਵਾਰ ਵਾਲਿਆਂ ਦਾ ਮਨੋਰੰਜਨ ਕਰਦੀ ਹਾਂ ਮੇਰੇ ਬੱਚੇ ਮੇਰੇ ਵੱਲੋਂ ਗਾਏ ਛੋਟੇ ਛੋਟੇ ਟੋਟਕੇ ਜੋ ਮੈਂ ਉਹਨਾਂ ਨੂੰ ਹਸਾਉਣ ਲਈ ਗਾਉਂਦੀ ਹਾਂ ਉਹਨਾਂ ਨੂੰ ਬਹੁਤ ਹੀ ਪਸੰਦ ਕਰਦੇ ਨੇ ਅਤੇ ਉਹ ਕਹਿੰਦੇ ਨੇ ਮੰਮਾ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਅਤੇ ਸਾਨੂੰ ਬੜਾ ਹੀ ਚੰਗਾ ਲੱਗਦਾ ਹੈ